ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਹੈ ਮੈਂ ਪਠਾਨਕੋਟ ਤੋਂ ਬੋਲਦੀ ਪਈ ਹਾਂ ਮੈਂ ਤੁਹਾਨੂੰ ਇਸ ਕਰਕੇ ਫੋਨ ਕੀਤਾ ਕਿਉਂਕਿ ਮੈਂ ਯਾਤਰਾ ਜਾਣਾ ਚਾਹੁੰਦੀ ਹਾਂ ਔਰ ਮੈਨੂੰ ਦੋ ਗੱਡੀਆਂ ਦੀ ਲੋੜ ਹੈ ਸਰ ਗੱਡੀਆਂ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਜਿਸ ਵਿੱਚ ਪੰਜ ਮੈਂਬਰ ਮੇਰੇ ਨੇ ਪੰਜ ਮੇਰੀ ਸਿਸਟਰ ਦੇ ਔਰ ਗੱਡੀਆਂ ਡਰਾਈਵਰ ਵੀ ਚੰਗੇ ਹੋਣੇ ਚਾਹੀਦੇ ਨੇ ਜੋ ਕਿ ਸਾਨੂੰ ਚੰਗੀ ਤਰ੍ਹਾਂ ਉੱਥੇ ਪਹੁੰਚਾ ਸਕਣ ਔਰ ਅਸੀਂ ਚੰਗੀ ਤਰ੍ਹਾਂ ਯਾਤਰਾ ਕਰਕੇ ਵਾਪਸ ਆ ਜਾਈਏ ਤਾਂ ਆਪਣੇ ਡਰਾਈਵਰ ਨੂੰ ਟਾਈਮ ਸਿਰ ਭੇਜ ਦਿਓ ਔਰ ਵਾ ਵਾਪਸ ਆ ਸਕੀਏ